ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਦੁਪਹਿਰ ਨੂੰ ਮੈਂ ਖਾਣੇ ਵਿੱਚ ਰਾਜਮਾਹ ਜਿਸ ਤਰ੍ਹਾਂ ਕਿ ਰਾਜਮਾਹ ਨੂੰ ਅਸੀਂ ਛੇੜ ਦਿੰਦੇ ਹਾਂ ਪਹਿਲਾਂ ਗਰਮ ਪਾਣੀ ਵਿੱਚ ਭਿਓ ਦਿੰਦੇ ਹਾਂ ਫਿਰ ਉਸ ਨੂੰ ਅਸੀ ਉਬਾਲਦੇ ਹਾਂ ਫਿਰ ਤੜਕਾ ਲਗਾਉਂਦੇ ਹਾਂ ਤੜਕਾ ਲਗਾ ਕੇ ਫਿਰ ਰਾਜਮਾਹ ਬਣਾ ਕੇ ਉਸ ਤੋਂ ਬਾਅਦ ਚਾਵਲ ਬਣਾਉਂਦੇ ਹਾਂ ਦੁਪਹਿਰ ਨੂੰ ਕੋਈ ਸਾਡੇ ਘਰ ਗੈਸਟ ਆਏ ਉਹਨਾਂ ਵਾਸਤੇ ਪਕੌੜੇ ਜਿਸ ਤਰ੍ਹਾਂ ਕਿ ਤੇਲ ਗਰਮ ਕਰਕੇ ਬੇਸਣ ਬੇਸਣ ਵਿੱਚ ਆਲੂ ਗੋਭੀ ਕੁਛ ਵੀ ਪਾ ਸਕਦੇ ਹਾਂ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਅਸੀਂ ਉਹਨੂੰ ਫਰਾਈ ਕਰਕੇ ਆਪਣੇ ਗੈਸਟ ਨੂੰ ਜੋ ਗੈਸਟ ਆਏ ਹੋਏ ਨੇ ਉਹਨਾਂ ਨੂੰ ਅਸੀਂ ਇਨਵਾਈਟ ਕਰਦੇ ਹਾਂ ਖੁਆਉਂਦੇ ਹਾਂ ਔਰ ਰਾਤ ਨੂੰ ਅਸੀਂ ਖਾਣੇ ਵਿੱਚ ਚਾਵਲ ਜਿਸ ਤਰ੍ਹਾਂ ਫੁਲਕਾ ਦਾਲ ਕੁਛ ਵੀ ਬਣਾ ਸਕਦੇ ਹਾਂ ਜਿਸ ਤਰ੍ਹਾਂ ਕਿ ਦਾਲ ਨੂੰ ਪਹਿਲੇ ਉਬਾਲਣਾ ਤੜਕਾ ਲਗਾਉਣਾ ਫਿਰ ਇਸ ਇਸ ਤਰ੍ਹਾਂ ਅਸੀਂ ਖਾਣਾ ਪਕਾਉਂਦੇ ਹਾਂ ਰਾਤ ਨੂੰ ਔਰ ਦਿਨ ਨੂੰ